ਮੌਜੂਦਾ ਘਟਨਾ ਦੇਖੋ ਮੈਨੂੰ ਇੱਕੋ ਯਾਦ ਆ ਰਹੀ ਹੈ ਹਫ਼ਤੇ ਕੁ ਪਹਿਲਾਂ ਦੀ ਗੱਲ ਹੈ ਜੀ ਅਸੀਂ ਚੰਡੀਗੜ੍ਹ ਜਾ ਰਹੇ ਸੀ ਪਟਿਆਲੇ ਤੋਂ ਅਤੇ ਠੰਡ ਕਰਕੇ ਜਿਹੜਾ ਹੈਗਾ ਰਸਤੇ 'ਚ ਲੰਗਰ ਲੱਗਿਆ ਹੋਇਆ ਸੀਗਾ ਅਤੇ ਉੱਥੇ ਘਟਨਾ ਮੈਨੂੰ ਇਹ ਯਾਦ ਆ ਗਈ ਜੀ ਲੰਗਰ ਦੇ ਕੋਲ ਸਾਡੀ ਗੱਡੀ ਦਾ ਟੈਰ ਖ਼ਰਾਬ ਹੋ ਗਿਆ ਅਤੇ ਉੱਥੇ ਚਾਹ ਦਾ ਲੰਗਰ ਸੀ ਨਾਲ ਬ੍ਰੈਡ ਸੀ ਪਿੰਡਾਂ ਵਾਲਿਆਂ ਨੇ ਲਾਏ ਹੋਏ ਸੀ ਠੰਡ ਕਰਕੇ ਅਸੀਂ ਉੱਥੇ ਰੁਕੇ ਉਹਨਾਂ ਨੇ ਸਾਨੂੰ ਚਾਹ ਦਿੱਤੀ ਨਾਲ ਉਹਨਾਂ ਨੇ ਸਾਨੂੰ ਬ੍ਰੈਡ ਦਿੱਤੀ ਅਤੇ ਫਿਰ ਉਹਨਾਂ ਨੇ ਸਾਡੀ ਮਦਦ ਕੀਤੀ ਇੱਕ ਨੇੜੇ ਦਾ ਕੋਈ ਮਕੈਨਿਕ ਲੱਭਣ ਲਈ ਫਿਰ ਅਸੀਂ ਮਕੈਨਿਕ ਕੋਲ ਗਏ ਅਸੀਂ ਉਹ ਤੋਂ ਗੱਡੀ ਠੀਕ ਕਰਵਾਈ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਸਾਡੇ ਕੋਲ ਖੁੱਲ੍ਹੇ ਪੈਸੇ ਨਹੀਂ ਹੈਗੇ ਅਤੇ ਮਕੈਨਿਕ ਕਹਿੰਦਾ ਕਿ ਸੱਤ ਸੌ ਰਪਏ ਬਣ ਗਏ ਮਕੈਨਿਕ ਕੋਲ ਖੁੱਲ੍ਹੇ ਪੈਸੇ ਨਹੀਂ ਸੀਗੇ ਫਿਰ ਅਸੀਂ ਲੱਭੀਏ ਕਿ ਖੁੱਲ੍ਹੇ ਪੈਸੇ ਕਿੱਥੇ ਨੇ ਫਿਰ ਜਿੱਥੇ ਲੰਗਰ ਲੱਗਿਆ ਹੋਇਆ ਸੀ ਉੱਥੋਂ ਦੋ ਚਾਰ ਮੁੰਡੇ ਆਏ ਕਹਿੰਦੇ ਕੀ ਹੋ ਗਿਆ ਅਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਪੈਸੇ ਹੈ ਨਹੀਂ ਐਵੇਂ ਖੁੱਲ੍ਹੇ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰ ਦਿੰਦਾ ਫਿਰ ਉਹਨੇ ਖੁੱਲ੍ਹੇ ਪੈਸੇ ਦਿੱਤੇ ਫਿਰ ਜਾਂਦਾ ਜਾਂਦਾ ਸਾਨੂੰ ਚਾਹ ਲੰਗਰ ਦੀ ਬੜੀ ਸਵਾਦ ਲੱਗੀ ਅਸੀਂ ਜਾਂਦੇ ਹੋਏ ਇੱਕ ਵਾਰੀ ਫਿਰ ਚਾਹ ਪੀ ਲਈ ਲੰਗਰ ਦੀ ਅਤੇ ਨਾਲ ਬ੍ਰੈਡ ਖਾ ਲਏ ਫਿਰ ਇੰਨੇ ਨੂੰ ਅਸੀਂ ਗੂਗਲ ਪੇ ਤੋਂ ਪੈਸੇ ਮੰਗਵਾ ਕੇ ਉਹ ਜਿਹੜੇ ਮੁੰਡੇ ਨੇ ਮਕੈਨਿਕ ਨੂੰ ਪੈਸੇ ਦਿੱਤੇ ਸੀ ਉਹਨੂੰ ਪੈਸੇ ਦੇ ਦਿੱਤੇ ਘਟਨਾ ਬੜੀ ਦਿਲ ਦਿਲਚਸਪ ਜੀ ਲੱਗੀ ਮੈਨੂੰ ਜੀ ਕਿ ਉਹ ਬਾਈ ਸਾਨੂੰ ਜਾਣਦਾ ਵੀ ਨਹੀਂ ਸੀ ਕਹਿੰਦਾ ਤੁਹਾਡੀ ਮੈਂ ਮਦਦ ਕਰ ਦੂੰਗਾ ਅਤੇ ਅਸੀਂ ਉਹਤੋਂ ਬਾਅਦ ਫਿਰ ਚੰਡੀਗੜ੍ਹ ਚਲੇ ਗਏ ਫਿਰ ਅਸੀਂ ਸਾਰਾ ਦਿਨ ਉੱਥੇ ਬਿਤਾ ਕੇ ਸ਼ਾਮ ਨੂੰ ਘਰ ਨੂੰ ਵਾਪਸ ਆ ਗਏ ਬਸ ਜੀ ਇਹੀ ਸੀ ਦਿਲਚਸਪ ਘਟਨਾ